ਸਤਿ ਸ਼੍ਰੀ ਅਕਾਲ ਜੀ ਹਾਂ ਮੇਰੇ ਕੋਲ ਬਹੁਤ ਸਾਰੀਆਂ ਪੁਰਾਣੀਆਂ ਫੋਟੋਆਂ ਹਨ ਜਿਹਨਾਂ ਦੀ ਹਾਰਡ ਕਾਪੀ ਮੇਰੇ ਕੋਲ ਪਈ ਹੈ ਸਭ ਤੋਂ ਪਹਿਲਾਂ ਜਿਹੜੀ ਹਾਰਡ ਕਾਪੀ ਆ ਉਹ ਮੇਰੀ ਬਚਪਨ ਦੇ ਵਿੱਚ ਲਈ ਗਈ ਸੀ ਜਿਹੜੀ ਮੇਰੇ ਕੋਲ ਹੈ ਅੱਜ ਵੀ ਉਹ ਮੇਰੇ ਪਹਿਲੇ ਬਰਥਡੇ ਦੇ ਉੱਪਰ ਜਦੋਂ ਅਸੀਂ ਕੇਕ ਕੱਟਿਆ ਸੀ ਤਾਂ ਉਸ ਟਾਈਮ 'ਤੇ ਮੇਰੇ ਚਾਚਾ ਜੀ ਨੇ ਸਾਡੇ ਪਹਿਲੇ ਕੈਮਰੇ ਦੇ ਵਿੱਚੋਂ ਮੇਰੀ ਫੋਟੋ ਕਲਿਕ ਕਲਿਕ ਕੀਤੀ ਸੀ ਉਹ ਫੋਟੋ ਨੂੰ ਦੇਖ ਕੇ ਅੱਜ ਵੀ ਮੈਂ ਬੜੀ ਭਾਵੁਕ ਹੋ ਜਾਂਦੀ ਹਾਂ ਭਾਵੇਂ ਕਿ ਅੱਜ ਡੀਜਿਟਲਾਈਜੇਸ਼ਨ ਦਾ ਜ਼ਮਾਨਾ ਹੈ ਲੋਕ ਲੋਕਾਂ ਕੋਲ ਬਹੁਤ ਸਾਰੇ ਕੈਮਰਾ ਮੋਬਾਇਲ ਕੈਮਰੇ ਮੋਬਾਈਲ ਦੇ ਵਿੱਚ ਹੀ ਆ ਗਏ ਹਨ ਮੋਬਾਈਲ ਦੇ ਵਿੱਚ ਅੱਜ ਕੱਲ੍ਹ ਬਹੁਤ ਸੋਹਣੀਆ ਸੋਹਣੀਆ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਪਰ ਜੋ ਕੈਮਰੇ ਦੇ ਨਾਲ ਖਿੱਚਣ ਪਰ ਫੋਟੋਆਂ ਖਿੱਚਣ ਦਾ ਜਿਹੜਾ ਚਾਅ ਹੁੰਦਾ ਸੀ ਨਾ ਉਹਦਾ ਕੋਈ ਵੀ ਮੁੱਲ ਨਹੀਂ ਹੈ ਅਸੀਂ ਕੈਮਰਿਆਂ ਦੇ ਵਿੱਚ ਫੋਨ ਦੇ ਕੈਮਰਿਆਂ ਦੇ ਵਿੱਚ ਫੋਟੋਆਂ ਖਿੱਚ ਤਾਂ ਲੈਂਦੇ ਹਾਂ ਪਰ ਉਹਨਾਂ ਦੇ ਨਾਲ ਉਹ ਜੋ ਮਜ਼ਾ ਸਾਨੂੰ ਹਾਰਡ ਕਾਪੀ ਨੂੰ ਦੇਖ ਕੇ ਆਉਂਦਾ ਸੀ ਉਹ ਮਜ਼ਾ ਸਾਨੂੰ ਉਹਨਾਂ ਕੈਮਰੇ ਦੇ ਫੋਨ ਦੇ ਕੈਮਰੇ ਨਾਲ ਖਿੱਚੀਆਂ ਹੋਈਆਂ ਫੋਟੋਆਂ ਦੇ ਵਿੱਚ ਨਹੀਂ ਆਉਂਦਾ ਧੰਨਵਾਦ